ਪੰਜਾਬ ਪੂਰੇ ਵਿਸ਼ਵ ਦੇ ਵਿੱਚ ਆਪਣੇ ਅਮੀਰ ਸੱਭਿਆਚਾਰ ਦੇ ਲਈ ਜਾਣਿਆ ਜਾਂਦਾ ਜਿਹਦੇ ਵਿੱਚ ਬਹੁਤ ਸਾਰੀਆਂ ਪਰੰਪਰਾਵਾਂ ਨੂੰ ਨਿਭਾਇਆ ਜਾਂਦਾ ਹੈ ਬਹੁਤ ਸਾਰੇ ਤਿਉਹਾਰ ਰੀਤੀ ਰਿਵਾਜ਼ ਬਹੁਤ ਸਾਰੀਆਂ ਰਸਮਾਂ ਜਿਹੜੀਆਂ ਕਿ ਸੱਭਿਆਚਾਰਕ ਤੌਰ 'ਤੇ ਮਾਨਤਾ ਰੱਖਦੀਆਂ ਜਿਹਨਾਂ ਦਾ ਆਪਣਾ ਇੱਕ ਖਾਸ ਮਹੱਤਵ ਹੈ ਉਹ ਵਿਆਹਾਂ ਦੇ ਵਿੱਚ ਵੀ ਅਤੇ ਤਿਉਹਾਰਾਂ ਦੇ ਵਿੱਚ ਵੀ ਅਪਣਾਏ ਜਾਂਦੇ ਹਨ ਜਿਵੇਂ ਕਿ ਪੰਜਾਬ ਦੇ ਵਿੱਚ ਦਿਵਾਲੀ ਦੇ ਮੌਕੇ ਦੀਵੇ ਰੱਖਣ ਦਾ ਤਿਉਹਾਰ ਹੈ ਉਸ ਨੂੰ ਪੰਜਾਬ ਦੇ ਵਿੱਚ ਵੀ ਪੂਰੇ ਦੇ ਭਾਰਤ ਦੇ ਵਿੱਚ ਚਾਹੇ ਮਨਾਇਆ ਜਾਂਦਾ ਪਰ ਪੰਜਾਬ ਦੇ ਵਿੱਚ ਵੀ ਇਸ ਨੂੰ ਬੰਦੀ ਛੋੜ ਦਿਵਸ ਦੇ ਹਵਾਲੇ ਨਾਲ ਹੋਰ ਵੀ ਮਹੱਤਵ ਦਿੱਤਾ ਜਾਂਦਾ ਅਤੇ ਇਸ ਦਿਨ ਸਾਡੇ ਘਰਾਂ ਦੇ ਬਨੇਰਿਆਂ ਉੱਪਰ ਦੀਵੇ ਰੱਖੇ ਜਾਂਦੇ ਹਨ ਉਸ ਦਿਨ ਸਾਡੇ ਘਰਾਂ ਦੇ ਬੂਹੇ ਆ ਜਿਹੜੇ ਉਹ ਖੁੱਲ੍ਹੇ ਰੱਖੇ ਜਾਂਦੇ ਹਨ ਤਾਂ ਜੋ ਲੱਛਮੀ ਦਾ ਪ੍ਰਵੇਸ਼ ਹੋ ਸਕੇ ਇਸ ਤੋਂ ਨਾਲ ਵਿਆਹਵਾਂ ਦੇ ਵਿੱਚ ਘੋੜੀ ਚੜ੍ਹਨ ਦਾ ਮੁੰਡੇ ਨੂੰ ਭਾਬੀਆਂ ਦੁਆਰਾ ਸੁਰਮਾ ਪਾਉਣ ਦਾ ਮੁੰਡੇ ਨੂੰ ਗਾਨੇ ਬੰਨ੍ਹਣ ਦਾ ਇਸ ਤੋਂ ਇਲਾਵਾ ਕੁੜੀ ਨੂੰ ਵੀ ਹਲਦੀ ਦੀ ਰਸਮ ਹੁੰਦੀ ਹੈ ਅਤੇ ਮੁੰਡੇ ਲਈ ਵੀ ਹਲਦੀ ਦੀ ਰਸਮ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ ਜਿਹੜਾ ਲਾਵਾਂ ਲੈਣ ਦਾ ਸੱਭਿਆਚਾਰਕ ਰਿਵਾਜ਼ ਹੈ ਉਹ ਵੀ ਸਾਡੇ ਪਰਿਵਾਰ ਦੇ ਵਿੱਚ ਅਪਣਾਇਆ ਜਾਂਦਾ ਸਾਡੇ ਪਰਿਵਾਰ ਦੇ ਵਿੱਚ ਇਹਨਾਂ ਤਿਉਹਾਰਾਂ ਨੂੰ ਖਾਸ ਤਰਜੀਹ ਦਿੱਤੀ ਜਾਂਦੀ ਹੈ ਚਾਹੇ ਹੁਣ ਨਵੇਂ ਸਮੇਂ ਦੇ ਨਾਲ ਬਹੁਤ ਸਾਰੇ ਤਿਉਹਾਰ ਪਿੱਛੇ ਪੈ ਰਹੇ ਆ ਬਹੁਤ ਸਾਰੇ ਤਿਉਹਾਰਾਂ ਨੂੰ ਮਨਾਉਣ ਤੋਂ ਕਿਨਾਰਾ ਕੀਤਾ ਜਾਂਦਾ ਬਹੁਤ ਸਾਰੀਆਂ ਪਰੰਪਰਾਵਾਂ ਨੂੰ ਛੱਡਿਆ ਜਾ ਰਿਹਾ ਹੈ ਪਰ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਤਾਂ ਖਾਸ ਕਰਕੇ ਪਿੰਡਾਂ ਦੇ ਵਿੱਚ ਰਹਿ ਰਿਹਾ ਮੇਰਾ ਪਰਿਵਾਰ ਇਹਨਾ ਸਭ ਪਰੰਪਰਾਵਾਂ ਨੂੰ ਹੁਣ ਵੀ ਉਸੇ ਤਰੀਕੇ ਨਾਲ ਨਿਭਾ ਰਿਹਾ ਹੈ